ਹਾਂ ਹਾਂਜੀ ਕੰਪਿਊਟਰ ਟੈਕਨੀਸ਼ੀਅਨ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਮੈਮ ਮੈਂ ਰਵਿੰਦਰ ਗੱਲ ਕਰ ਰਿਹਾਂ ਹਾਂਜੀ ਮੈਮ ਮੈਂ ਨਾ ਐਕਚੂਲ਼ੀ ਮੇਰੇ ਖ਼ਿਆਲ ਤੋਂ ਮਹੀਨਾ ਪਹਿਲਾਂ ਕੰਪਿਊਟਰ ਪਰਚੇਸ ਕੀਤਾ ਸੀ ਤੁਹਾਡੀ ਸ਼ੋਪ ਤੋਂ ਅਤੇ ਸਮਹਾਓ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕੀ ਨਹੀਂ ਹੋਇਆ ਇਹ ਵਾਰ ਵਾਰ ਮੇਰਾ ਕੰਪਿਊਟਰ ਨਾ ਰੀਸਟਾਟ ਹੋਈ ਜਾਂਦਾ ਹੈ ਅਤੇ ਮੈਨੂੰ ਓਹਦੀ ਬਹੁਤ ਜ਼ਿਆਦਾ ਮਤਲਬ ਕਿ ਅਸਿਸਟੈਂਸ ਤੁਹਾਡੇ ਤਰਫੋਂ ਚਾਹੀਦੀ ਹੈ ਵੀ ਸਾਨੂੰ ਨਾ ਸਾਰਾ ਤੁਹਾਨੂੰ ਪਤਾ ਸਾਰਾ ਬਿਜ਼ਨੈੱਸ ਚੱਲਦਾ ਹੈ ਕੰਪਿਊਟਰ ਦੇ ਉੱਤੇ ਅਤੇ ਮੈਨੂੰ ਤਾਂ ਬੜੀ ਪ੍ਰੇਸ਼ਾਨੀ ਆ ਰਹੀ ਹੈ ਹੁਣ ਮੇਰਾ ਸਿਸਟਮ ਵਾਰ ਰੀਸਟਾਟ ਹੋ ਰਿਹਾ ਇਮੀਡੇਟਲੀ ਤੁਸੀਂ ਕੁਛ ਕਰ ਸਕਦੇ ਹੋ ਅੱਜ ਹੀ ਆਈ ਹੈ ਮੈਮ ਅੱਜ ਹੀ ਆਈ ਹੈ ਮਹੀਨੇ ਪਹਿਲਾਂ ਪਰਚੇਸ ਕੀਤਾ ਨਾ ਅਤੇ ਮੈਂ ਬਸ ਸ਼ਾਮੀ ਹੀ ਆਈ ਹੈ ਅਤੇ ਤੁਹਾਨੂੰ ਟ੍ਰਾਈ ਕਰ ਰਿਹਾ ਸੀ ਮੈਂ ਕਿਹਾ ਹੁਣ ਫ਼ੋਨ ਕਰਨਾ ਟਾਇਮ ਮਿਲਿਆ ਸੀਗਾ ਮੈਨੂੰ ਹਾਂਜੀ ਹਾਂਜੀ ਅੱਛਾ ਜੀ ਮੈਂ ਇੱਕ ਵਾਰੀ ਟਰਾਈ ਕਰ ਮੈਂ ਨਾਲ਼ ਹੀ ਬੈਠਾ ਆ ਵੈਸੇ ਮੈਂ ਕਰ ਚੁੱਕਿਆ ਇੱਕ ਵਾਰੀ ਅਤੇ ਤੁਹਾਡੇ ਸਾਹਮਣੇ ਕਰ ਲੈਨਾ ਕਿਉਂਕਿ ਤੁਸੀਂ ਟੈਕਨੀਸ਼ੀਅਨ ਹੈਗੇ ਹੋ ਚੀਜ਼ਾਂ ਦੇ ਤੁਹਾਨੂੰ ਐਕਸਪਰਟ ਓ ਤਾਂ ਮੈਂ ਇੱਕ ਵਾਰੀ ਚੈੱਕ ਕਰ ਲੈਨਾ ਕੀ ਕਹਿ ਰਹੇ ਹੋ ਥੋੜ੍ਹਾ ਮੈਂ ਦੁਬਾਰਾ ਬਟਨ ਓਨ ਓਨ ਕਰ ਲਿਆ ਠੀਕ ਹੈ ਮੈਮ ਮੈਂ ਕਰਕੇ ਦੇਖਦਾਂ ਇੱਕ ਵਾਰੀ ਮੈਂ ਇੱਕ ਵਾਰੀ ਚੈੱਕ ਕਰ ਲਾਂ ਇੱਕ ਮਿੰਟ ਦਸ ਸੈਕੰਡ ਰੁਕੋ ਦਸ ਸੈਕੰਡ ਪ੍ਰੈੱਸ ਕਰਨਾ ਨਾ ਅਸੀਂ ਹਾਂ ਹਾਂ

ਹਾਂਜੀ ਮੈਮ ਕੀਤਾ ਮੈਂ ਹਾਂਜੀ ਤੁਸੀਂ ਮੈਮ ਐੱਲ ਈ ਡੀ ਐੱਲ ਈ ਡੀ ਓਨ ਹੋ ਗੀ ਨਾ ਮੇਰੀ ਅਤੇ ਸਿਸਟਮ ਹੁਣ ਚੱਲ ਗਿਆ ਹੈ ਲੇਕਿਨ ਅਸੀਂ ਦੁਬਾਰਾ ਓਹ ਹੀ ਜਿੱਦਾਂ ਹੀ ਆਉਂਦੀ ਹੈ ਨਾ ਤੁਹਾਡੇ ਬਰੈਂਡ ਦੀ ਜਿੱਦਾਂ ਐਕਸੀਅਲ ਦਾ ਲਿਖਿਆ ਆਉਂਦਾ ਹੈ ਅਤੇ ਉੱਦਾਂ ਹੀ ਫ਼ਿਰ ਬੰਦ ਵੀ ਹੋ ਜਾਂਦਾ ਨਾਲ਼ ਈ ਨਹੀਂ ਮੈਮ ਉਹ ਚੀਜ਼ ਤਾਂ ਅੱਗੇ ਆਉਂਦੀ ਨਾ ਉਹ ਚੀਜ਼ ਆ ਨਹੀਂ ਰਹੀ ਹੈ ਮੈਂ ਇੱਕ ਵਾਰੀ ਦੁਬਾਰਾ ਟਰਾਈ ਕਰਦਾ ਉਹ ਨਾ ਬਾਇਓਜ ਦਾ ਹੁੰਦਾ ਉਹ ਨਹੀਂ ਆ ਰਿਹਾ ਮੈਮ ਮੈਂ ਇੱਕ ਵਾਰੀ ਥੋੜ੍ਹਾ ਐਕਸੀਅਲ ਦੇ ਅੰਦਰ ਥੋੜ੍ਹਾ ਚੈੱਕ ਕਰਦਾ ਇੱਕ ਸੈਕੰਡ ਹੋਲਡ ਕਰੋ ਦੁਬਾਰਾ ਟਰਾਈ ਕਰਦਾ ਮੈਂ ਹਾਂਜੀ ਮੈਮ ਮੈਂ ਚੈੱਕ ਕੀਤਾ ਹੈ ਅਤੇ ਹੁਣ ਬਾਇਓਜ ਲਿਖਿਆ ਆ ਗਿਆ ਹਾਂਜੀ ਹੁਣ ਦੱਸੋ ਮੈਮ ਕੀ ਕਰਨਾ ਹਮ ਹਮ ਮੈਂ ਕਰਤਾ ਮੈਂ ਐਪ ਬੰਦ ਐਪ ਬੰਦ ਕਰਤਾ ਮੈਮ ਹੁਣ ਪ੍ਰੋਸੈਸਿੰਗ ਹੀ ਪ੍ਰੋਸੈਸਿੰਗ ਹੀ ਹੋ ਰਹੀ ਹੈ ਮੈਮ ਹੋ ਰਹੀ ਹੈ ਪ੍ਰੋਸੈਸਿੰਗ ਮੈਂ ਇੱਕ ਵਾਰੀ ਚੈੱਕ ਕਰ ਲੈਂਦਾ ਅਗਰ ਇਹ ਦਿੱਕਤ ਦੁਬਾਰਾ ਆਉਂਦੀ ਹੈ ਨਾ ਮੈਨੂੰ ਤਾਂ ਫ਼ਿਰ ਮੈਂ ਤੁਹਾਡੇ ਸ਼ੋਪ 'ਤੇ ਕੱਲ੍ਹ ਵਿਜ਼ਿਟ ਕਰਦਾ ਵੈਸੇ ਫਿਲਹਾਲ ਮੇਰੇ ਖ਼ਿਆਲ ਤੋਂ ਓਲਮੋਸਟ ਚੱਲ ਪਿਆ ਪਹਿਲੇ ਰੀਸਟਾਟ ਹੋ ਰਿਹਾ ਸੀਗਾ ਮੈਨੂੰ ਹੁਣ ਚੱਲ ਪਿਆ ਲੱਗਦਾ ਅਤੇ ਮੈਂ ਇੱਕ ਵਾਰ ਚਲਾ ਕੇ ਨਾ ਰੀਸਟਾਟ ਦੁਬਾਰਾ ਰੀਸਟਾਟ ਹੋਇਆ ਨਾ ਸ਼ੋਪ 'ਤੇ ਫੇਰ ਵਿਜ਼ਿਟ ਕਰਾਂਗਾ ਮੈਂ ਬਾਕੀ ਥੈਂਕ ਯੂ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਕੀ ਤੁਸੀਂ ਇੰਨਾ ਟਾਈਮ ਦਿੱਤਾ ਮੈਨੂੰ ਅਤੇ ਬਾਕੀ ਮੈਂ ਬਹੁਤ ਅੱਛਾ ਲੱਗ ਰਿਹਾ ਮੈਮ ਕੀ ਤੁਹਾਡਾ ਰੇਕੋਮੈਂਡ ਵੀ ਕੀਤਾ ਸੀ ਮੈਂ ਮੈਂ ਇੰਨੇ ਤਾਂ ਚਲਾ ਰਿਹਾ ਸੀ ਪਤਾ ਨਹੀਂ ਕੀ ਹੋਇਆ ਇੱਕਦਮ ਤੋਂ ਰੀਸਟਾਟ ਹੋਣ ਲੱਗ ਗਿਆ ਦੋ ਵਾਰੀ ਹੋ ਗਿਆ ਸੀ ਮੈਂ ਕਿਹਾ ਚਲੋ ਇੱਕ ਵਾਰੀ ਫ਼ੋਨ ਕਰ ਲੀਏ ਕੋਈ ਫਾਈਲਾਂ ਨਾ ਕਰੱਪਟ ਹੋ ਜਾਣ ਬਾਕੀ ਤੁਸੀਂ ਬਾਇਓ ਸੈਟਿੰਗ ਕਰਵਾ ਤੀ ਮੈਮ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਮੈਮ ਠੀਕ ਹੈ ਠੀਕ ਹੈ ਜੀ ਮੈਮ ਥੈਂਕ ਯੂ ਥੈਂਕ ਯੂ ਮੈਮ ਓਕੇ ਜੀ ਹਾਂਜੀ ਹਾਂਜੀ ਥੈਂਕ ਯੂ